ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂ ਮੈਂ ਮੈਂ ਵਧੀਆ ਭਾਅ ਜੀ ਤੁਸੀਂ ਦੱਸੋ ਭਾਅ ਜੀ ਮੈਂ ਤੁਹਾਡੇ ਕੋਲੇਜ 'ਚ ਨਾ ਐਡਮਿਸ਼ਨ ਲੈਣੀ ਸੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੋਲੇਜ ਆ ਠੀਕ ਆ ਮੇਰੇ ਆਉਣ ਵਾਸਤੇ ਵੈਸੇ ਅੱਛਾ ਅਤੇ ਭਾਅ ਜੀ ਮੈਂ ਫਿਰ ਤਾਂ ਫਿਰ ਹੋਸਟਲ ਵਿੱਚ ਹੀ ਆਉਣਾ ਅਤੇ ਫਿਰ ਹੋਸਟਲ ਲਾਈਫ ਕਿੱਦਾਂ ਇੱਦਾਂ ਦੀ ਓਕੇ ਓਕੇ ਭਾਅ ਜੀ ਮਿਹਰਬਾਨੀ ਤੁਹਾਡੀ ਜੀ ਓਕੇ ਭਾਅ ਜੀ ਬਾਏ ਬਾਏ